ਸਤਿ ਸ਼੍ਰੀ ਅਕਾਲ ਮੈਂ ਰਮਨਪ੍ਰੀਤ ਕੌਰ ਬੋਲ ਰਹੀ ਹਾਂ ਮੈਂ ਤੁਹਾਡੀ ਇੰਸਟਾਗ੍ਰਾਮ ਪੇਜ਼ ਤੋਂ ਕੁਝ ਮੇਕਅਪ ਪ੍ਰੋਡਕਟ ਮੰਗਵਾਏ ਸੀ ਜੋ ਕਿ ਮੈਨੂੰ ਅੱਜ ਤਿੰਨ ਮਨ ਤਿੰਨ ਮਹੀਨੇ ਬਾਅਦ ਪ੍ਰਾਪਤ ਹੋਏ ਹਨ ਮੈਂ ਜਦੋਂ ਇਸਦੀ ਪੈਕਿੰਗ ਦੇਖੀ ਤਾਂ ਇਹ ਬਹੁਤ ਹੀ ਗੰਦੀ ਸੀ ਇਸ ਦੀ ਜਦੋਂ ਮੈਂ ਇਹ ਖੋਲ੍ਹੀ ਤਾਂ ਇਸਦੇ ਆਈ ਸ਼ੈਡੋ ਟੁੱਟੇ ਹੋਏ ਸਨ ਹਾਈਲਾਈਟਰ ਤਿੰਨ ਦਿਖਾਏ ਦਿਖਾਈ ਦਿੱਤੇ ਸਨ ਪਰ ਇਹ ਦੋ ਹੀ ਮਿਲੇ ਹਨ ਇਸਦੇ ਬ੍ਰੱਸ਼ਿਜ਼ ਵੀ ਬੱਤੀ ਸਨ ਪਰ ਮੈਨੂੰ ਅਠਾਰਾਂ ਬਰੱਸ਼ ਪ੍ਰਾਪਤ ਹੋਏ ਹਨ ਜੋ ਕਿ ਟੁੱਟੇ ਹੋਏ ਹਨ ਇਹਨਾਂ ਵਿੱਚ ਮੈਨੂੰ ਇੱਦਾਂ ਲੱਗਦਾ ਹੈ ਜਿਵੇਂ ਕੁਝ ਪ੍ਰੋਡਕਟ ਕੱਢੇ ਹੋਏ ਹਨ ਫਿਕਸਿੰਗ ਸਪਰੇ ਦੀ ਡੇਟ ਐਕਸਪਾਇਰੀ ਹੈ ਜਦੋਂ ਮੈਂ ਇਸਦਾ ਫਾਈਨ ਫਾਊਂਡੇਸ਼ਨ ਖੋਲ੍ਹ ਕੇ ਦੇਖਿਆ ਤਾਂ ਉਸਦੀ ਕੋਆਂਟਿਟੀ ਬਹੁਤ ਹੀ ਜ਼ਿਆਦਾ ਘੱਟ ਸੀ ਅਤੇ ਜਦੋਂ ਉਸਨੂੰ ਮੈਂ ਆਪਣੀ ਸਕਿੰਨ 'ਤੇ ਲਗਾਇਆ ਤਾਂ ਉਸਨੇ ਮੇਰੀ ਸਕਿੰਨ ਨੂੰ ਲਾਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਮੇਰੇ ਪਿੰਪਲਸ ਹੋ ਗਏ ਇਸਦਾ ਕਨਸੀਲਰ ਬਿਲਕੁਲ ਹੀ ਖਾਲੀ ਸੀ ਅਤੇ ਮੇਕਅੱਪ ਬਲੈਂਡਰ ਨਕਲੀ ਸੀ ਜਦੋਂ ਮੈਂ ਆਈਲੈਸਿਸ਼ ਦਾ ਬੋਕਸ ਖੋਲ੍ਹਿਆ ਤਾਂ ਉਹਨਾਂ ਵਿੱਚੋਂ ਮੈਨੂੰ ਇੱਕ ਆਈਲੈਸ਼ ਪ੍ਰਾਪਤ ਹੋਈ ਇਸਦੀ ਮੈਨੂੰ ਤਿੰਨ ਟੈਨ ਦਸ ਲਿਪਸਟਿਕ ਦਿਖਾਈ ਦਿੱਤੀ ਸੀ ਪਰ ਮਿਲੀਆਂ ਮੈਨੂੰ ਚਾਰ ਹੀ ਹਨ ਜੋ ਕਿ ਲੋ ਕੋਐਲਿਟੀ ਦੀਆਂ ਹਨ ਮੈਂ ਆਪਣੀ ਮੇਰੇ ਦੋਸਤਾਂ ਨੇ ਵੀ ਮੇਕਅੱਪ ਇਹ ਮੇਕਅੱਪ ਔਡਰ ਕੀਤਾ ਸੀ ਅਤੇ ਮੈਂ ਉਹਨਾਂ ਨੂੰ ਕਹਾਂਗੀ ਕਿ ਇਹ ਉਹਨਾਂ ਨੂੰ ਕੈਂਸਲ ਕਰ ਦੇਵੇ ਕਰ ਦੇਵੇ ਅਤੇ ਮੇਰੇ ਵੀ ਪੈਸੇ ਰਿਫੰਡ ਕੀਤੇ ਜਾਣ